ਜਦੋਂ ਮੇਰੇ ਪਾਸ ਸਮਾਂ ਨਾ ਹੋਵੇ ਮਤਲਬ ਕਿਤੇ ਜਾਣਾ ਹੋਵੇ ਸਮਾਂ ਘੱਟ ਹੋਵੇ ਤਾਂ ਫਿਰ ਮੈਂ ਉਦੋਂ ਸੋਚਦੀ ਹਾਂ ਕਿ ਜਲਦੀ ਤੋਂ ਜਲਦੀ ਕੀ ਬਣਾਇਆ ਜਾਵੇ ਫਿਰ ਨਮਕੀਨ ਚਾਵਲ ਜਿਵੇਂ ਦਾਲ ਹੋ ਗਈ ਬੱਚਿਆਂ ਵਾਸਤੇ ਮੈਗੀ ਹੋ ਗਈ ਫਾਸਟ ਫੂਡ ਹੋ ਗਿਆ ਵੀ ਜਿਹੜਾ ਜਲਦੀ ਤੋਂ ਜਲਦੀ ਬਣਾਇਆ ਜਾ ਸਕੇ ਅਤੇ ਸਮੇਂ ਸਿਰ ਪਹੁੰਚਿਆ ਜਾ ਸਕੇ